ਦੀਵਾਲੀ ਦਾ ਤਿਉਹਾਰ ਸਭ ਤੋਂ ਵੱਧ ਮਹੱਤਵਪੂਰਨ ਤਿਉਹਾਰ ਹੈ ਇਹਦੇ ਵਿੱਚ ਪੰਜ ਛੁੱਟੀਆਂ ਮਿਲਦੀਆਂ ਨੇ ਅਸੀਂ ਪਟਾਕੇ ਵਗੈਰਾ ਚਲਾ ਕੇ ਦੀਵੇ ਜਲਾ ਕੇ ਗਰੀਨ ਦੀਵਾਲੀ ਮਨਾਉਨੇ ਹਾਂ ਇਹ ਤਿਉਹਾਰ ਐ ਮਨਾਇਆ ਜਾਂਦਾ